ਥਾਵਾਂ ਤਾਂ ਵੈਸੇ ਬਹੁਤ ਵਧੀਆ ਵਧੀਆ ਹੈਗੀਆਂ ਵਾ ਆਪਣੇ ਇੱਥੇ ਬੜੀਆਂ ਵਧੀਆ ਵਧੀਆ ਅੱਛੀਆਂ ਅੱਛੀਆਂ ਵਾਂ ਜਿੱਦਾਂ ਕਿ ਲੋਕ ਜਾਣਾ ਪਸੰਦ ਕਰਦੇ ਆ ਬਟ ਮੈਨੂੰ ਜ਼ਿਆਦਾ ਮੈਂ ਇੱਕ ਵਾਰੀ ਗਈ ਸੀ ਕੇਦਾਰਨਾਥ ਛੁੱਟੀਆਂ 'ਚ ਮੈਨੂੰ ਛੁੱਟੀਆਂ ਸੀਗੀਆਂ ਅਤੇ ਉਦੋਂ ਮੈਂ ਗਈ ਸੀਗੀ ਕੇਦਾਰਨਾਥ ਮੈਨੂੰ ਉੱਥੇ ਜਾ ਕੇ ਬੜਾ ਵਧੀਆ ਲੱਗਾ ਉੱਥੋਂ ਦੇ ਹਿਲ ਸਟੇਸ਼ਨ ਉੱਥੋਂ ਦੇ ਪਹਾੜ ਬੜੇ ਵਧੀਆ ਵਧੀਆ ਸੀਗੇ ਫਿਰ ਉੱਥੇ ਮਤਲਬ ਕਿ ਠੰਡ ਤਾਂ ਬਹੁਤ ਸੀਗੀ ਬਟ ਜੋ ਅਸੀਂ ਇੰਜੋਏ ਕੀਤਾ ਉੱਥੋਂ ਦੀ ਉੱਥੋਂ ਦੀ ਆਰਤੀ ਉੱਥੋਂ ਦੀ ਸਾਰਾ ਕੁਛ ਇਹ ਚੀਜ਼ਾਂ ਬਹੁਤ ਵਧੀਆ ਲੱਗੀਆਂ ਜਿਹਦੇ ਕਰਕੇ ਕਿ ਬਹੁਤ ਵਧੀਆ ਲੱਗਦਾ ਮੈਨੂੰ ਉੱਥੇ ਜਾਣਾ ਅਤੇ ਉਹ ਮੇਰੇ ਲਈ ਫੇਵਰੇਟ ਜਗ੍ਹਾ ਆ ਅਤੇ ਉਹ 'ਚ ਸ਼ਿਵਜੀ ਜੀ ਦੇ ਸਾਨੂੰ ਦਰਸ਼ਨ ਹੋਏ ਬੜੇ ਵਧੀਆ ਤਰੀਕੇ ਨਾਲ ਅਤੇ ਬਹੁਤ ਮਜ਼ਾ ਕੀਤਾ ਇੰਜੋਏ ਕੀਤਾ